ਹਾਂਜੀ ਮੇਰੀ ਕਲਾ ਚਿੱਤਰਕਾਰੀ ਹੈ ਜਿਸਦੇ ਕਾਰਨ ਮੈਂ ਆਪਣੀ ਕਲਾ ਨੂੰ ਹੋਰ ਵੀ ਜ਼ਿਆਦਾ ਉਸਾਰਦਾ ਹਾਂ ਚਿੱਤਰ ਬਣਾ ਬਣਾ ਕੇ ਅਤੇ ਉਹ ਚਿੱਤਰ ਮੈਂ ਅਸਕ ਅਕਸਰ ਰੰਗਾਂ ਦੇ ਬਣਾਉਂਦਾ ਰੰਗਾਂ ਰੰਗ ਚਾਹੀਦੇ ਹਨ ਮੈਨੂੰ ਰੰਗ ਮਿਲਦੇ ਹਨ ਮੈਨੂੰ ਨੇੜੇ ਦੀਆਂ ਸਟੇਸ਼ਨਰੀ ਦੁਕਾਨਾਂ ਤੋਂ ਸਟੇਸ਼ਨਰੀ ਜਦੋਂ ਮੈਂ ਪਹੁੰਚਦਾ ਹਾਂ ਉੱਥੇ ਮੈਂ ਸਭ ਤੋਂ ਪਹਿਲਾਂ ਉਹਨਾਂ ਤੋਂ ਇੱਕ ਲੈਂਦਾ ਹਾਂ ਚਾਰਟ ਚਾਟ ਇਹ ਉਹ ਵਾਲਾ ਲੈਂਦਾ ਹੁੰਦਾ ਜਿ ਜਿਹਦੇ ਆਰ ਪਾਰ ਰੰਗ ਨਾ ਜਾਵੇ ਨਾ ਰੰਗ ਨਾ ਖਿੰਡੇ ਅਤੇ ਫਿਰ ਮੈਂ ਉਸ ਤੋਂ ਲੈਂਦਾ ਹਾਂ ਪੇਂਟ ਦਾ ਸਮਾਨ ਬਰੱਸ਼ ਪੈਨਸਿਲ ਅਤੇ ਡਾਰਕ ਡਾਰਕ ਸ਼ੇਡਸ ਵਾਲੀਆਂ ਪੈਸਸਿਲਜ਼ ਅਤੇ ਜਦੋਂ ਮੈਂ ਕਿਸੇ ਚੀਜ਼ ਨੂੰ ਅਕਿਰਤੀ ਦੇਣੀ ਹੈ ਉਸ ਦੀ ਲਈ ਇੱਕ ਅਲੱਗ ਤਰ੍ਹਾਂ ਦੀ ਇੱਕ ਪੈਨਸਿਲ ਮਿਲਦੀ ਹੈ ਉਹ ਸਿਰਫ਼ ਜਿਹੜੀ ਕਿ ਉਸ ਸਟੋਰ ਤੋਂ ਅਵੇਲੇਬਲ ਹੁੰਦੀ ਹੈ ਉਸ ਸਟੋਰ ਤੋਂ ਵੀ ਇੱਕੋ ਖਾਸ ਜਗ੍ਹਾ ਤੋਂ ਮੰਗਵਾਉਂਦੇ ਹਨ ਜਿਹੜੀ ਕਿ ਉਸ ਸਟੋਰ 'ਤੇ ਮਿਲਦੀ ਹੈ ਉਹ ਚੀਜ਼ ਅਤੇ ਉਹ ਮੇਰੀ ਸਭ ਤੋਂ ਮਨਭਾਉਂਦੀ ਚੀਜ਼ ਹੈ ਉਹ ਪੈਨਸਲ ਉਸਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਫੀਚਰ ਨੇ ਜਿਹੜੀ ਕਿ ਸਾਈਡ ਬਾਈ ਸਾਈਡ ਸ਼ੇਡਿੰਗ ਦੇ ਲਈ ਵਰਤੀ ਜਾਂਦੀ ਹੈ ਅਤੇ ਉਹ ਬਹੁਤ ਵਧੀਆ ਸ਼ੇਡ ਕਰਦੀ ਹੈ ਜਿਸ ਦੇ ਕਰਕੇ ਮੈਨੂੰ ਉਹ ਸਟੋਰ ਪਸੰਦ ਹੈ ਅਤੇ ਆਪਣੀ ਮੈਂ ਮਨਪਸੰਦ ਕਲਾ ਜਿਹੜੀ ਮੇਰੀ ਮੈਂ ਉੱਥੋਂ ਹੀ ਸਾਰੀ ਸਮੱਗਰੀ ਆਪਣੀ ਇਕੱਠੀ ਕਰਦਾ ਅਤੇ ਉਹ ਜਿਹੜੀ ਸ਼ੋਪ ਦਾ ਨਾਮ ਹੈ ਉਹ ਸ਼ੌਪ ਦਾ ਨਾਮ ਹੈ ਹਰਚੰਦ ਸ਼ੋਪ ਅਤੇ ਉੱਥੋਂ ਬਹੁਤ ਇਹੋ ਜਿਹੀਆਂ ਚੀਜ਼ਾਂ ਹਨ ਜਿਹੜੀਆਂ ਕਿ ਕਈ ਤਰ੍ਹਾਂ ਦੀਆਂ ਸਮੱਗਰੀਆਂ ਮਿਲ ਜਾਂਦੀਆਂ ਨੇ ਬੱਚਿਆਂ ਵਾਸਤੇ ਵੀ ਮਿਲ ਜਾਂਦੀਆਂ ਹਨ ਆਮ ਤੌਰ 'ਤੇ ਮੈਂ ਤਾਂ ਆਪਣੀ ਕਲਾ ਦਾ ਸਮਾਨ ਸਾਰਾ ਸਟੇਸ਼ਨਰੀ ਦਾ ਉੱਥੋਂ ਹੀ ਲੈਂਦਾ